ਮੈਂ ਇੱਕ ਸੰਗੀਤ ਪ੍ਰੇਮੀ ਹਾਂ ਅਤੇ ਮੈਂ ਦੋ ਹਜ਼ਾਰ ਉੱਨੀ ਵਿੱਚ ਪਟਿਆਲਾ ਦੇ ਰਾਜ ਕਿਲੇ ਵਿੱਚ ਪੰ ਭਾਰਤ ਦੀ ਮਸ਼ਹੂਰ ਗਾਇਕਾ ਜਿਨ੍ਹਾਂ ਦਾ ਨਾਮ ਕੌਸ਼ਕੀ ਚੱਕਰਵਰਤੀ ਹੈ ਜੋ ਕਿ ਕਲਾਸੀਕਲ ਸੰਗੀਤ ਦੇ ਬਹੁਤ ਮਾਹਰ ਗਾਇਕਾ ਹਨ ਉਹਨਾਂ ਨੂੰ ਸੁਣਿਆ ਅਤੇ ਮੈਂ ਆਪਣੇ ਸਾਥੀਆਂ ਸਮੇਤ ਸ਼ਾਮ ਨੂੰ ਸੱਤ ਵਜੇ ਤੋਂ ਲੈ ਕੇ ਸਾਢੇ ਨੌ ਵਜੇ ਤੱਕ ਉਹਨਾਂ ਨੂੰ ਸੁਣਿਆ ਇੰਨਾ ਗਰਮੀ ਦਾ ਮੌਸਮ ਹੋਣ ਦੇ ਬਾਵਜੂਦ ਵੀ ਉੱਥੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਜਾਂ ਗਰਮੀ ਮਹਿਸੂਸ ਨਹੀਂ ਹੋਈ ਕਿਉਂਕਿ ਉਹਨਾਂ ਦੀ ਆਵਾਜ਼ ਅਤੇ ਉਹਨਾਂ ਦੀ ਮਧੁਰਤਾ ਇੰਨੀ ਜ਼ਿਆਦਾ ਸੀ ਕਿ ਜਦੋਂ ਜਦੋਂ ਸੁਣਦੇ ਸੀਗੇ ਸੀਨੇ ਵਿੱਚ ਠੰਡ ਪੈਂਦੀ ਸੀ ਅਤੇ ਉੱਥੋਂ ਦੇ ਜੋ ਮਹਾਰਾਣੀ ਪ੍ਰਨੀਤ ਕੌਰ ਸਨ ਉਹਨਾਂ ਨੇ ਕੌਸ਼ਕੀ ਚੱਕਰਵਰਤੀ ਜੀ ਨੂੰ ਸਨਮਾਨਿਤ ਵੀ ਕੀਤਾ ਅਤੇ ਦੁਬਾਰਾ ਸੱਦਾ ਦਿੱਤਾ ਕਿ ਹਰ ਸਾਲ ਇਸੇ ਤਰ੍ਹਾਂ ਤੁਸੀਂ ਪਟਿਆਲੇ ਦੇ ਇਸ ਰਾਜ ਘਰਾਣੇ ਵਿੱਚ ਰੌਣਕਾਂ ਲਾਇਆ ਕਰੋ ਅਤੇ ਮੈਨੂੰ ਉਹਨਾਂ ਨੂੰ ਲਾਈਵ ਤੋਂ ਇਲਾਵਾ ਯੂਟਿਊਬ 'ਤੇ ਵੀ ਸੁਣਨਾ ਪਸੰਦ ਹੈ